ਕੂਕਿੰਗ ਦੀ ਗੱਲ ਕਰਾਂ ਜੇ ਮੈਂ ਕੂਕਿੰਗ ਦੇ ਵਿੱਚ ਜਿਹੜੀ ਜੋ ਵੀ ਸਮਾਨ ਬਣਾਉਂਦੀ ਹਾਂ ਜੋ ਵੀ ਖਾਣ ਲਈ ਕੋਈ ਚੀਜ਼ ਬਣਾਉਂਦੀ ਹਾਂ ਤਾਂ ਮੈਂ ਜ਼ਿਆਦਾਤਰ ਉਹਨੂੰ ਵੇਸਟ ਨਹੀਂ ਕਰਦੀ ਕਿਉਂਕਿ ਵੇਸਟ ਕਰਨਾ ਬਹੁਤ ਗਲਤ ਗੱਲ ਹੈ ਪਰਮਾਤਮਾ ਅਨਾਜ ਬੜੀ ਮੁਸ਼ਕਿਲ ਨਾਲ ਦਿੰਦਾ ਅਤੇ ਹਾਲ ਹੀ ਦੀ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਮੈਂ ਰਾਤੀਂ ਦਾਲ ਬਣਾ ਤੀ ਖਾਣੇ ਵਾਸਤੇ ਅਤੇ ਦਾਲ 'ਚ ਨਾ ਮੈਨੂੰ ਨਮਕ ਤੇਜ਼ ਲੱਗਿਆ ਗਲਤੀ ਨਾਲ ਮੇਰੇ ਤੋਂ ਪੈ ਗਿਆ ਅਤੇ ਮੈਂ ਦਾਲ ਸਰਵ ਨਹੀਂ ਕੀਤੀ ਰੱਖ ਲਈ ਪਰ ਸੁੱਟੀ ਨਹੀਂ ਅਤੇ ਮੈਂ ਘਰਦਿਆਂ ਲਈ ਸਬਜ਼ੀ ਹੋਰ ਬਣਾਈ ਘਰਦਿਆਂ ਨੂੰ ਰਾਤ ਨੂੰ ਰੋਟੀ ਸਬਜ਼ੀ ਨਾਲ ਖਿਲਾ ਕੇ ਮੈਂ ਸਵੇਰੇ ਉਹ ਦਾਲ ਆਟੇ ਵਿੱਚ ਮਿਕਸ ਕਰਕੇ ਉਹਦੇ ਗੁ ਆਟਾ ਗੁੰਨ ਲਿਆ ਅਤੇ ਉਹਦੇ ਪਰੌਂਠੇ ਬਣਾ ਲਏ ਅਤੇ ਸਾਰਿਆਂ ਨੂੰ ਉਹ ਨਾਸ਼ਤੇ ਵਿੱਚ ਸਰਵ ਕੀਤਾ ਇਸ ਤਰੀਕੇ ਨਾਲ ਦਾਲ ਵੀ ਨਹੀਂ ਵੇਸਟ ਹੋਈ ਅਤੇ ਸਾਰੇ ਪਰੌਂਠੇ ਖਾ ਕੇ ਖੁਸ਼ ਵੀ ਹੋ ਗਏ ਅਤੇ ਸ਼ਾਮ ਲਈ ਸਬਜ਼ੀ ਦਾ ਜਿਹੜਾ ਸੀਗਾ ਸਬਜ਼ੀ ਦੇ ਨਾਲ ਉਹਨਾਂ ਨੇ ਰੋਟੀ ਖਾਦੀ ਅਤੇ ਰਾਤ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਈ ਇਸ ਲਈ ਸਾਨੂੰ ਤਾਂ ਸਾਰਿਆਂ ਨੂੰ ਚਾਹੀਦਾ ਵੀ ਬਰਬਾਦੀ ਨਾ ਕੀਤੀ ਜਾਵੇ ਭੋਜਨ ਦੀ